ਅੱਜ ਤੋਂ ਦਸ ਸਾਲ ਪਹਿਲਾਂ ਅਸੀਂ ਏ ਸੀ ਮਾਰਕੀਟ ਪਟਿਆਲਾ ਤੋਂ ਸਾਗ ਕੱਟਣ ਵਾਲੀ ਮਸ਼ੀਨ ਲਿਆਂਦੀ ਅਤੇ ਉਹ ਬਹੁਤ ਹੀ ਵਧੀਆ ਨਿਕਲੀ ਅਤੇ ਜਿਸ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਗ ਕੱਟ ਹੁੰਦਾ ਹੈ ਅਤੇ ਉਹ ਤਿੰਨ ਗੰਡਾਸਿਆਂ ਵਾਲੀ ਮਸ਼ੀਨ ਹੈ ਜਿਸ ਨਾਲ ਜਿਸਦੇ ਨਾਲ ਕਿ ਬਹੁਤ ਹੀ ਬਰੀਕ ਸਾਗ ਕੱਟ ਹੁੰਦਾ ਹੈ ਅਤੇ ਬਹੁਤ ਛੇਤੀ ਰਿੱਝਦਾ ਹੈ